ਅਮਿਤਾਬ ਬੱਚਨ ਫਿਲਮ ਸਿਤਾਰਿਆਂ ਵਿੱਚ ਚਮਕਦੇ ਹੋਏ ਉਸ ਧਰੂ ਤਾਰੇ ਵਾਂਗ ਹੈ ਜੋ ਆਪਣੀ ਰੋਸ਼ਨੀ ਨਾਲ ਹਰ ਇੱਕ ਨੂੰ ਆਪਣੇ ਵੱਲ ਖਿੱਚ ਪਾਉਂਦਾ ਹੈ ਮੈਂ ਵੀ ਅਮਿਤਾਬ ਬੱਚਨ ਨੂੰ ਆਪਣੀ ਜ਼ਿੰਦਗੀ ਦਾ ਮਾਡਲ ਦੇ ਰੂਪ ਵਿੱਚ ਮੰਨਿਆ ਅਤੇ ਸੁਪਨਾ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਿਲਿਆ ਜਾਵੇ ਕਿਉਂਕਿ ਮੇਰੇ ਲਈ ਫਿਲਮੀ ਦੁਨੀਆ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ ਜ ਜਦੋਂ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਸੋਨੀ 'ਤੇ ਆਇਆ ਤਾਂ ਮੈਨੂੰ ਵੀ ਆਪਣਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਇਆ ਭਾਵ ਅਮਿਤਾਬ ਬੱਚਨ ਨਾਲ ਮਿਲਣ ਦਾ ਰਸਤਾ ਨਜ਼ਰ ਆਇਆ ਫਿਰ ਬਹੁਤ ਯਤਨ ਕਰਨ ਤੋਂ ਬਾਅਦ ਮੈਨੂੰ ਕੌਣ ਬਣੇਗਾ ਕਰੋੜਪਤੀ ਦੇ ਸੀਜ਼ਨ ਤਿੰਨ ਵਿੱਚ ਅਮਿਤਾਬ ਬੱਚਨ ਦੇ ਸਾਹਮਣੇ ਹੋਟ ਸੀਟ 'ਤੇ ਬੈਠਣ ਦਾ ਸਮਾਂ ਸੁਭਾਗ ਸਮਾਂ ਆ ਗਿਆ ਪਰ ਮੈਨੂੰ ਇਹ ਸਮਾਂ ਸੱਚ ਪ੍ਰਤੀਤ ਨਹੀਂ ਹੋ ਰਿਹਾ ਸੀ ਅਤੇ ਉਤਸੁਕਤਾ ਵੱਸ ਮੈਂ ਅਮਿਤਾਬ ਬੱਚਨ ਜੀ ਨੂੰ ਉਹਨਾਂ ਦੀ ਤਰੱਕੀ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਕਈ ਸਵਾਲ ਪੁੱਛੇ ਜਿਨ੍ਹਾਂ 'ਤੇ ਉਹਨਾਂ ਨੇ ਬੜੀ ਸਿਧਾਰਤਾ ਨਾਲ ਜਵਾਬ ਦਿੱਤੇ